ਜਾਨਵਰਾਂ ਨੂੰ ਚਰਾਉਣ ਲਈ ਕਈ ਤਰ੍ਹਾਂ ਦੀਆਂ ਚਰਾਂਦਾ ਬਣੀਆਂ ਹੋਈਆਂ ਹਨ ਪਰ ਇਹ ਉਪਲੱਬਤਾ ਵਾਤਾਵਰਨ 'ਤੇ ਸਥਾਨਕ ਜਮੀਨੀ ਹਾਲਾਤ 'ਤੇ ਨਿਰਭਰ ਕਰਦੀ ਹੈ ਵਾਤਾਵਰਨ ਵਿੱਚ ਤਬਦੀਲੀਆਂ ਜਿਵੇਂ ਖਰਾਬ ਜਲਵਾਯੂ ਕਠੋਰ ਮੌਸਮ ਪਲਾਸਟਿਕ ਪ੍ਰਦੂਸ਼ਣ ਅਤੇ ਪਾਣੀ ਦੀ ਕਮੀ ਜਾਨਵਰਾਂ 'ਤੇ ਕਈ ਤਰ੍ਹਾਂ ਦੇ ਬੁਰੇ ਪ੍ਰਭਾਵ ਪਾਉਂਦੀ ਹੈ ਜਾਨਵਰਾਂ ਦੀ ਸਿਹਤ ਦੀ ਗੁਣਵੰਤਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ

ਸੋਕਾ ਪੈਣ ਕਰਕੇ ਵਿਹੜੇ ਸੁੱਕ ਜਾਂਦੇ ਹੈ ਜਿਸ ਨਾਲ ਚਾਰੇ ਦੀ ਕਮੀ ਹੋ ਜਾਂਦੀ ਹੈ ਜਾਨਵਰਾਂ ਚ ਭੁੱਖ ਮਰੀ ਹੋ ਜਾਂਦੀ ਹੈ ਇਸ ਕਰਕੇ ਜਾਨਵਰਾਂ ਨੂੰ ਪੋਸ਼ਣ ਵਾਲੇ ਚਾਰੇ ਦੀ ਲੋੜ ਪੈਂਦੀ ਹੈ ਪਾਣੀ ਦੀ ਕਮੀ ਨਾਲ ਵੀ ਜਾਨਵਰਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਪੈਦਾ ਹੁੰਦੀ ਹੈ ਪਾਣੀ ਦੀ ਕਮੀ ਨਾਲ ਜਾਨਵਰਾਂ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ ਅਤੇ ਇਹਨਾਂ ਦੀ ਸਿਹਤ ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਕਰਦੀ ਹੈ ਪ੍ਰਦੂਸ਼ਣ ਨਾਲ ਵੀ ਫਰਕ ਪੈਂਦਾ ਹੈ ਜਿਵੇਂ ਆਪਾਂ ਵੀ ਪਲਾਸਟਿਕ ਦੇ ਲਿਫਾਫੇ ਦੇ ਵਿੱਚ ਕੋਈ ਖਾਣ ਵਾਲੀਆਂ ਚੀਜ਼ਾਂ ਪਾ ਕੇ ਬਾਹਰ ਸਿੱਟ ਦਿੰਦੇ ਹਾਂ ਉਹ ਉਵੇਂ ਹੀ ਚੁੱਕ ਕੇ ਪਸ਼ੂ ਖਾ ਜਾਂਦੇ ਹੈ ਉਹਨਾਂ ਦੇ ਅੰਦਰ ਜਾ ਕੇ ਜਹਿਰੀ ਜਹਿਰ ਬਣ ਜਾਂਦਾ ਹੈ ਜਦੋਂ ਉਹ ਅੰਦਰ ਗੱਲਦਾ ਨੀਗਾ ਕਈ ਵਾਰੀ ਇਸੇ ਤਰ੍ਹਾਂ ਖਾਣ ਨਾਲ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਜਿਵੇਂ ਅਵਾਰਾ ਗਾਈਆਂ ਢੱਠੇ ਫਿਰਦੇ ਹੈ ਉਹਨਾਂ ਦਾ ਕਈ ਵਾਰੀ ਵੀ ਮਰਨ ਬਾਅਦ ਜਦੋਂ ਚੀਰਫਾੜ ਕਰਦੇ ਹੈ ਅਤੇ ਅੰਦਰੋਂ ਕਿੰਨੇ ਕਿੰਨੇ ਲਿਫਾਫੇ ਨਿਕਲਦੇ ਹੈ ਇਸ ਕਰਕੇ ਵੀ ਇਹ ਵੀ ਬਹੁਤ ਸਿਹਤ 'ਤੇ ਅਸਰ ਪਾਉਂਦੀ ਹੈ ਵੀ ਸਾਨੂੰ ਖਾਣ ਵਾਲੀਆਂ ਚੀਜ਼ਾਂ ਪਲਾਸਟਿਕ ਦੇ ਲਿਫਾਫਿਆਂ 'ਚ ਨਹੀਂ ਸਿੱਟਣੀਆਂ ਚਾਹੀਦੀਆਂ ਵੀ ਜੇ ਬਾਹਰ ਪਈਆਂ ਹੋਣਗੀਆਂ ਚੱਲੋ ਜਾਨਵਰ ਖਾ ਲੈਣਗੇ ਜਦੋਂ ਆਪਾਂ ਦੂਜਾ ਇਸ ਤਰ੍ਹਾਂ ਕਰਦੇ ਹੈ ਉਹ ਜਾਨਵਰ ਹੁਣ ਖੋਲ੍ਹ ਤਾਂ ਸਕਦੇ ਨਹੀਂ ਉਹ ਵਿਚਾਰੇ ਉਵੇਂ ਹੀ ਖਾ ਲੈਂਦੇ ਹੈ ਅਤੇ ਉਹ ਉਹਨਾਂ ਦੇ ਅੰਦਰ ਜਾ ਕੇ ਜਿਵੇਂ ਇੱਕ ਤਰ੍ਹਾਂ ਗੰਢ ਬਣ ਜਾਂਦੀ ਹੈ ਅਤੇ ਉਹ ਐਂ ਹੀ ਭੁੱਖ ਨਾਲ ਮਤਲਬ ਉਸ ਨਾਲ ਮਰ ਜਾਂਦੇ ਹੈ ਤਾਪਮਾਨ ਵਿੱਚ ਵਾਧਾ ਵੀ ਜਿਹੜਾ ਪਸ਼ੂਆਂ ਵਾਸਤੇ ਚੰਗਾ ਨਹੀਂ ਗਾ ਸਮਾ ਇਹਦੇ ਨਾਲ ਬਹੁਤ ਬਿਮਾਰੀਆਂ ਹੁੰਦੀਆਂ ਅਤੇ ਇਹਨਾਂ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਰਹਾਇਸ਼ੀ ਇਲਾਕਿਆਂ 'ਚ ਵੀ ਵਾਤਾਵਰਨ ਦੀਆਂ ਤਬਦੀਲੀਆਂ ਕਾਰਣ ਲੋਕਾਂ ਦੇ ਘਰ ਭੀੜੇ ਹੁੰਦੇ ਹੈ ਉਹ ਘੱਟ ਹਵਾ ਵਾਲੀ ਥਾਂ 'ਤੇ ਜਵਾ ਪਸੂਆਂ ਨੂੰ ਉਵੇਂ ਹੀ ਬੰਨੀ ਰੱਖਦੇ ਹੈ ਇਸ ਕਰਕੇ ਪਸ਼ੂਆਂ ਨੂੰ ਖੁੱਲ੍ਹੀਆਂ ਚਰਾਂਦਾਂ 'ਚ ਚਰਾ ਕੇ ਹੀ ਮਤਲਬ ਰਹਿਣਾ ਚਾਹੀਦਾ ਹੈ ਓਸ ਨਾਲ ਜਾਨਵਰ ਤੁਰ ਫਿਰ ਕੇ ਨਾਲ ਤਾਂ ਠੀਕ ਰਹਿੰਦੇ ਆ ਨਾਲ ਬਾਹਰੋਂ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਖਾਂਦੇ ਹੈ ਉਹ ਜਿਹੜੀਆਂ ਉਹਨਾਂ ਦਾ ਮਤਲਬ ਦੁੱਧ ਹੁੰਦਾ ਉਹ ਆਪਣੇ ਲਈ ਗੁਣਕਾਰੀ ਹੁੰਦਾ ਹੈ ਜਿਹੜਾ ਹੁਣ ਆਪਾਂ ਜੇ ਪਸ਼ੂਆਂ ਨੂੰ ਚਰਾਵਾਂਗੇ ਗੰਦਾ ਮੰਦਾ ਤਾਂ ਪਸ਼ੂ ਵੀ ਉਹੋ ਜਿਹਾ ਜ਼ਹਿਰੀਲਾ ਖਾਣਾ ਖਾ ਕੇ ਜ਼ਹਿਰੀਲਾ ਹੀ ਦੁੱਧ ਘਿਓ ਦੇਣਗੇ ਅਤੇ ਉਹ ਆਪਣੀ ਸਿਹਤ ਵਾਸਤੇ ਵੀ ਮਾੜਾ ਹੈ ਜਿਨ੍ਹਾਂ ਕਰਕੇ ਜਾਨਵਰਾਂ ਦੀ ਸਿਹਤ ਅਤੇ ਜੀਵਨ ਦੀ ਬੁਰੀ ਪ੍ਰਭਾਵਿਤ ਕਰਦੇ ਹੈ ਵਾਤਾਵਰਨ ਲਈ ਪਾਲਤੂ ਜਾਨਵਰਾਂ ਨੂੰ ਸੰਭਾਲ ਕੇ ਰੱਖਣ ਲਈ ਹੋਰ ਉਪਾਅ ਕਰਨ ਦੀ ਲੋੜ ਹੈ ਜਿਵੇਂ ਖੁੱਲੀਆਂ ਚਰਾਂਦਾ ਹੋਣ ਅੱਜ ਕੱਲ੍ਹ ਤਾਂ ਆਪਣੀਆਂ ਸਰਕਾਰਾਂ ਜੋ ਚਰਾਂਦਾ ਉਹਨਾਂ ਨੂੰ ਵੇਚੀ ਜਾਂਦੀਆਂ ਜੋ ਦੂਜਾ ਬਾਹਰ ਬਣਿਆ ਥਾਵਾਂ ਬਸ ਉਹਨਾਂ 'ਤੇ ਕੋਈ ਫੈਕਟਰੀਆਂ ਲਾਈ ਜਾਂਦੇ ਹੈ ਪਸ਼ੂਆਂ ਦੇ ਚਰਨ ਵਾਸਤੇ ਕੋਈ ਥਾਂ ਹੀ ਨਹੀਂ ਰਹਿ ਜਾਂਦੀ ਗੀ ਇਸ ਕਰਕੇ ਸਾਨੂੰ ਉਹਨਾਂ ਦਾ ਕੋਈ ਨਾ ਕੋਈ ਅਰੇਂਜਮੈਂਟ ਕਰਨਾ ਚਾਹੀਦਾ ਹੈ ਇੱਧਰ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਇਸ ਤਰ੍ਹਾਂ ਆਪਣੀ ਇਹ ਨਸਲਾਂ ਹੀ ਖਤਮ ਹੋ ਜਾਣਗੀਆਂ ਕੁਛ ਤਾਂ ਗਰਮੀ ਦੇ ਪ੍ਰਭਾਵ ਹੈ ਕੁਛ ਵਾਤਾਵਰਨ ਦਾ ਹੋ ਜਾਂਦਾ ਕੁਛ ਪਾਣੀ ਦੀ ਘਾਟ ਹੋ ਜਾਂਦੀ ਹੈ ਇਸ ਕਰਕੇ ਵੀ ਕੁਛ ਥਾਵਾਂ 'ਤੇ ਰੱਖਣਾ ਚਾਹੀਦਾ ਸਰਕਾਰਾਂ ਨੂੰ ਵੀ ਜਿਵੇਂ ਪਸੂਆਂ ਨੂੰ ਪਾਣੀ ਦੇ ਵੀ ਬਣਾਏ ਹੋਣ ਤਲਾਅ ਵਗੈਰਾ ਵੀ ਪਸ਼ੂ ਨਹਾ ਸਕਣ ਉਹਦੇ ਵਿੱਚ ਬੈਠ ਸਕਣ ਪਾਣੀ ਪੀ ਸਕਣ ਪਰ ਇੱਥੇ ਕੀ ਹੁੰਦਾ ਵੀ ਆਪਾਂ ਤਾਂ ਬਾਰ ਦੇ ਵਿੱਚ ਵੀ ਕੋਈ ਭਾਂਡਾ ਨਹੀਂ ਰੱਖਦੇ ਵੀ ਕੋਈ ਜਾਨਵਰ ਪਾਣੀ ਪੀ ਲੂਗਾ ਕਿਉਂਕਿ ਇੱਥੇ ਵੀ ਪਸ਼ੂ ਖੜੂਗਾ ਇਹ ਗੰਦ ਪਾਊਗਾ ਪਰ ਨਹੀਂ ਆਪਾਂ ਨੂੰ ਜਾਨਵਰਾਂ ਦਾ ਫਿਰ ਵੀ ਧਿਆਨ ਰੱਖਣਾ ਚਾਹੀਦਾ